ਹਾਂ ਸਾਡੇ ਖੇਤੀ ਕਾਰਜਾਂ ਦੇ ਵਿੱਚ ਜਿਹੜੀ ਟੈਕਨੋਲਜੀ ਦੀ ਅਹਿਮ ਭੂਮਿਕਾ ਹੈ ਕਿਉਂਕਿ ਜਿੱਥੇ ਕੰਮ ਜਿਹੜਾ ਉਹ ਦਿਨਾਂ ਵਿੱਚ ਹੁੰਦਾ ਸੀਗਾ ਟੈਕਨੋਲਜੀ ਦੇ ਨਾਲ ਆਉਣ ਨਾਲ ਜਿਹੜਾ ਕੰਮ ਘੰਟਿਆਂ ਵਿੱਚ ਹੋ ਜਾਂਦਾ ਖਾਸ ਕਰਕੇ ਟਰੈਕਟਰ ਟਰੈਕਟਰਾਂ ਦੇ ਦੇ ਨਾਲ ਜਿਹੜੇ ਹੋਰ ਬਾਕੀ ਦੇ ਔਜ਼ਾਰ ਹੈਗੇ ਉਹਨਾਂ ਦੇ ਰਾਹੀਂ ਕੰਮ ਸੁਖਾਲਾ ਅਤੇ ਵਧੀਆ ਹੋ ਗਿਆ ਕਿਉਂਕਿ ਤਕਨੋਲਜੀ ਨੇ ਕਾਫੀ ਜਿੱਥੇ ਲੋਕਾਂ ਦੇ ਸਾਡੇ ਆਮ ਜੀਵਨ ਜ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਸਾਡੇ ਜਿਹੜੇ ਖੇਤੀ ਦੇ ਵਿੱਚ ਬੜਾ ਹੀ ਸਹਾਇਕ ਹੋ ਰਿਹਾ ਹਾਂ ਜਿੱਥੇ ਇਸਦੇ ਫਾਇਦੇ ਹੋਏ ਨਾ ਉੱਥੇ ਜਿਹੜੇ ਮਜ਼ਦੂਰਾਂ ਨੂੰ ਵੀ ਇਹਨਾਂ ਪ੍ਰਭਾਵਿਤ ਕੀਤਾ ਹੈ ਇੱਕ ਕਿਉਂਕਿ ਮਜ਼ਦੂਰਾਂ ਨੂੰ ਜਿੱਥੇ ਸਾਨੂੰ ਮਜ਼ਦੂਰੀ ਵਾਸਤੇ ਬਹੁਤ ਸਾਰੇ ਘਾਟ ਮਹਿਸੂਸ ਹੁੰਦੀ ਸੀਗੀ ਟੈਕਨੋਲਜੀ ਦੇ ਆਉਣ ਨਾਲ ਜਿਹੜੀ ਮਜ਼ਦੂਰਾਂ ਦੀ ਲੋੜ ਵੀ ਘਟੀ ਹੈ ਜਿੱਥੇ ਸਾਨੂੰ ਫਾਇਦਾ ਦੂਸਰੇ ਪਾਸੇ ਜਿਹੜੇ ਮਜ਼ਦੂਰ ਵੀ ਇਸ ਗੱਲ ਦਾ ਪ੍ਰਭਾਵਿਤ ਹੋਏ ਆ ਉਹਨਾਂ ਦੇ ਜਿਹੜੇ ਕੰਮ ਦੇ ਸੋਰਸ ਘਟੇ ਨੇ ਅਤੇ ਪਰ ਜੇ ਆਪਾਂ ਦੇਖੀਏ ਤਾਂ ਓਵਰਆਲ ਬਹੁਤ ਫਾਇਦਾ ਹੋਇਆ ਆ ਅਤੇ ਇਸ ਕਰਕੇ ਜਿਹੜਾ ਖੇਤੀ ਦੇ ਵਿੱਚ ਟੈਕਨੋਲਜੀ ਦਾ ਹੋਣਾ ਬਹੁਤ ਚੰਗੇ ਸੰਕੇਤ ਹੈਗੇ ਆ ਅਤੇ ਇਸ ਕਰਕੇ ਜਿਹੜੀ ਟੈਕਨੋਲਜੀ ਹੈ ਕਾਫੀ ਪ੍ਰਭਾਵਿਤ ਕਰ ਰਹੀ ਹੈ ਉਹਦੇ ਨਾਲ ਪੈਦਾਵਾਰ ਵੀ ਵਧੀ ਹੈ ਅਤੇ ਮਿਹਨਤ ਵੀ ਘਟੀ ਹੈ